ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਦੱਸੋ ਜੀ ਠੀਕ ਆ ਜੀ ਹਾਂਜੀ ਹਾਂਜੀ ਜ਼ਰੂਰ ਦੱਸ ਸਕਦੇ ਹਾਂ ਜੀ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੋ ਸਿੱਖਾਂ ਦੇ ਮੁੱਢਲੇ ਗੁਰੂ ਸਨ ਅਤੇ ਉਹਨਾਂ ਦਾ ਜਨਮ ਪਿੰਡ ਗੁਜਰਾਂਵਲ ਵਾਲੇ ਵਿਖੇ ਹੋਇਆ ਹਾਂ ਉਹ ਸ਼ੁਕਰਾ ਚੱਕਰੀਆ ਮਿਸਲ ਨੂੰ ਬਿਲੋਂਗ ਕਰਦੇ ਸਨ ਕੁੱਲ ਬਾਰਾਂ ਮਿਸਲਾ ਮਿਸਲਾਂ ਸਨ ਉਹਨਾਂ ਦੇ ਪਿਤਾ ਦਾ ਨਾਮ ਮਹਾਂ ਸਿੰਘ ਸੀ ਅਤੇ ਮਾਤਾ ਦਾ ਨਾਮ ਰਾਜ ਕੌਰ ਸੀ ਅਤੇ ਉਹਨਾਂ ਦਾ ਬਚਪਨ ਵਿੱਚ ਹੀ ਇੱਕ ਅੱਖ 'ਤੇ ਚੇਚਕ ਹੋ ਗਿਆ ਸੀ ਉਹਨਾਂ ਦੀ ਮਾਤਾ ਦੀ ਬਚਪਨ ਵਿੱਚ ਹੀ ਐਕਸਪਾਇਰ ਹੋ ਗਏ ਸਨ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਸੱਸ ਸਦਾ ਕੌਰ ਨੇ ਕੀਤਾ ਅਤੇ ਉਹਨਾਂ ਨੇ ਹਰਿਮੰਦਰ ਸਾਹਿਬ ਵਿੱਚ ਸੋਨੇ ਦੇ ਦਰਵਾਜੇ ਬਣਾਏ ਸਨ ਉਹਨਾਂ ਦਾ ਰਾਜ ਬਹੁਤ ਲੰਬਾ ਸੀ ਅਤੇ ਅੰਗਰੇਜ਼ੀ ਪ੍ਰਸ਼ਾਸਨ ਉਹਨਾਂ ਤੋਂ ਬਹੁਤ ਡਰਦਾ ਸੀ ਅਤੇ ਜਦੋਂ ਤੁਸੀਂ ਇੱਧਰ ਘੁੰਮਣ ਆਉਂਗੇ ਤਾਂ ਇੱਕ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ ਉਹਦੇ ਵੀ ਦਰਸ਼ਨ ਮੇਲੇ ਜ਼ਰੂਰ ਕਰਕੇ ਜਾਇਓ ਠੀਕ ਹੈ ਜੀ ਠੀਕ ਹੈ ਜੀ